ਵੀਰ ਜੀ ਮੈਂ ਰਾਤ ਨੂੰ ਪਹੁੰਚਾਂਗਾ ਮੈਂ ਟ੍ਰੇਨ ਰਾਹੀਂ ਆ ਰਿਹਾ ਅਤੇ ਮੈਂ ਦੇਰ ਰਾਤ ਨੂੰ ਮੈਨੂੰ ਕੋਈ ਟਾਈਮ ਦੋ ਜਾਂ ਢਾਈ ਦੇ ਵਿੱਚ ਵਿੱਚ ਮੈਂ ਤੁਹਾਡੇ ਕੋਲ ਪਹੁੰਚਾਂਗਾ ਅਤੇ ਮੇਰਾ ਪਹੁੰਚ ਮੈਂ ਬਠਿੰਡੇ ਸਟੇਸ਼ਨ ਦੇ ਉੱਤੇ ਪਹੁੰਚ ਜਾਵਾਂਗਾ ਅਤੇ ਤੁਸੀਂ ਮੈਨੂੰ ਸਟੇਸ਼ਨ ਦੇ ਬਾਹਰੋਂ ਤੁਸੀਂ ਰਾਤ ਨੂੰ ਮੈਨੂੰ ਲਿਜਾ ਸਕਦੇ ਹੋ ਅਤੇ ਮੈਨੂੰ ਸਟੇਸ਼ਨ ਤੋਂ ਚੱਕ ਕੇ ਬਸ ਸਟੈਂਡ ਬਠਿੰਡਾ ਤੱਕ ਬਸ ਸਟੈਂਡ ਰ ਰਜਿੰਦਰਾ ਕਲੋਨੀ ਦੇ ਕੋਲ ਪੋ ਛੱਡ ਸਕਦੇ ਹੋ ਕਿਰਪਾ ਕਰਕੇ ਮੈਨੂੰ ਹਾਂ ਜਾਂ ਨਾਂਹ ਦੇ ਵਿੱਚ ਜਵਾਬ ਦਿਓ ਅਤੇ ਮੈਨੂੰ ਰਾਤ ਨੂੰ ਲੇਟ ਹੋਣ ਕਾਰਨ ਮੈਂ ਤੁਹਾਨੂੰ ਇਹ ਕਸ਼ਟ ਕਰਨ ਦਾ ਕਸ਼ਟ ਕਰਨ ਵਾਸਤੇ ਕਹਿ ਰਿਹਾ ਵੀ ਮੈਨੂੰ ਰਾਤ ਨੂੰ ਹੋਰ ਮੇਰੇ ਕੋਲ ਅੱਗੇ ਟਰੇਨ ਜਦੋਂ ਵੀ ਮੇਰੀ ਟ੍ਰੇਨ ਉੱਥੇ ਸਟੇਸ਼ਨ 'ਤੇ ਪਹੁੰਚੇਗੀ ਉਸ ਤੋਂ ਇਲਾਵਾ ਮੇਰੇ ਕੋਲ ਕੋਈ ਵੀ ਕਾਰਨ ਨਹੀਂ ਹੈ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਮੈਨੂੰ ਬਠਿੰਡਾ ਸਟੇਸ਼ਨ ਤੋਂ ਲੈ ਕੇ ਮੈਨੂੰ ਬਸ ਸਟੈਂਡ ਮੇਰੇ ਆਪਦੇ ਘਰ ਤੱਕ ਰਜਿੰਦਰਾ ਕਲੋਨੀ ਦੇ ਵਿੱਚ ਛੱਡਿਆ ਜਾਵੇ ਕਿਰਪਾ ਕਰਕੇ ਮੇਰੀ ਬੇਨਤੀ ਸਵੀਕਾਰ ਕਰੋ